ਮੈਂ ਬਹੁਤ ਸਾਰੇ ਸਕੈਚ ਬਣਾਉਂਦਾ ਰਹਿੰਦਾ ਹਾਂ ਮੈਂ ਆਪਣੇ ਘਰ ਵਿੱਚ ਬਹੁਤ ਸਾਰੇ ਸਕੈਚ ਬਣਾ ਬਣਾ ਕੇ ਲਗਾਏ ਹੋਏ ਹਨ ਮੈਨੂੰ ਸਕੈਚ ਬਹੁਤ ਵਧੀਆ ਲੱਗਦੇ ਹਨ ਉਹ ਸਕੈਚ ਲੱਗਣ ਨਾਲ ਸਾਡੇ ਘਰ ਵਿ ਘਰ ਦੀਆਂ ਕੰਧਾਂ ਅਕਰਸ਼ਿਤ ਹੁੰਦੀਆਂ ਹਨ ਜਿਸ ਨਾਲ ਸਾਡਾ ਘਰ ਵਧੀਆ ਲੱਗਣ ਲੱਗ ਜਾਂਦਾ ਹੈ ਮੈਂ ਆਪਣੇ ਦੋਸਤਾਂ ਨੂੰ ਵੀ ਪੇਂਟਿੰਗਸ ਬਣਾ ਕੇ ਦਿੰਦਾ ਹਾਂ ਉਹਨਾਂ ਨੂੰ ਮੈਂ ਉਹਨਾਂ ਦੇ ਜਨਮਦਿਨ 'ਤੇ ਤੋਹਫੇ ਵਜੋਂ ਪੇਂਟਿੰਗਸ ਦਿੰਦਾ ਰਹਿੰਦਾ ਹਾਂ ਮੈਨੂੰ ਪੇਂਟਿੰਗਸ ਬਣਾਉਣ ਦਾ ਬਹੁਤ ਸ਼ੌਂਕ ਹੈ ਮੈਂ ਬਹੁਤ ਸੋਹਣੀਆਂ ਸੋਹਣੀਆਂ ਪੇਟਿੰਗਸ ਬਣਾਉਂਦਾ ਰਹਿੰਦਾ ਹਾਂ ਮੈਂ ਮੈਂ ਪੇਟਿੰਗਸ ਬਣਾਉਣ ਵਾਸਤੇ ਬਹੁਤ ਇੰਟਰਨੈੱਟ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਦਾ ਰਹਿੰਦਾ ਹਾਂ